ਹਾਂਜੀ ਸਾਨੂੰ ਪਾਣੀ ਦੀ ਸਪਲਾਈ ਮਿਲਦੀ ਹੈ ਪਾਣੀ ਜੀਵਨ ਲਈ ਬਹੁਤ ਜ਼ਰੂਰੀ ਹੈ ਪਾਣੀ ਦੇ ਬਿਨਾਂ ਜੀਵਨ ਦੀ ਗਤੀ ਨਹੀਂ ਹੈ ਕੋਈ ਵੀ ਇਨਸਾਨ ਪਾਣੀ ਦੇ ਬਿਨਾਂ ਨਹੀਂ ਰਹਿ ਸਕਦਾ ਜੇ ਇਨਸਾਨ ਨੂੰ ਪਾਣੀ ਨਹੀਂ ਮਿਲੇਗਾ ਤਾਂ ਉਹ ਮਰ ਜਾਵੇਗਾ ਪਾਣੀ ਜਿਵੇਂ ਜਿਵੇਂ ਇਨਸਾਨ ਵਾਸਤੇ ਹਵਾ ਜ਼ਰੂਰੀ ਹੈ ਸਾਹ ਲੈਣਾ ਜ਼ਰੂਰੀ ਹੈ ਖਾਣਾ ਜ਼ਰੂਰੀ ਹੈ ਪਾਣੀ ਉਸ ਤੋਂ ਵੱਧ ਜ਼ਰੂਰੀ ਹੈ ਬੰਦਾ ਖਾਣੇ ਤੋਂ ਬਿਨਾਂ ਰਹਿ ਸਕਦਾ ਹੈ ਪਰ ਪਾਣੀ ਦੇ ਬਿਨਾਂ ਨਹੀਂ ਰਹਿ ਸਕਦਾ ਇਸ ਦਾ ਸਾਫ਼ ਅਤੇ ਸਹੀ ਸਪਲਾਈ ਹੋਣਾ ਸਿਹਤ ਲਈ ਬਹੁਤ ਮਹੱਤਵਪੂਰਨ ਹੈ ਜੇ ਇਹ ਸਾਫ਼ ਹੋਵੇ ਤਾਂ ਆ ਆਸਾਨੀ ਨਾਲ ਉਪਲੱਬਧ ਹੋਵੇ ਤਾਂ ਇਹ ਲੋਕਾਂ ਦੀ ਭਲਾਈ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ ਪਾਣੀ ਦੀ ਸਾਫ਼ ਸਪਲਾਈ ਦੇ ਫ਼ਾਇਦੇ ਸਿਹਤ ਤੇ ਸਿਹਤ 'ਤੇ ਅਸਰ ਸਾਫ਼ ਪਾਣੀ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਹੈ ਜੇ ਲੋਕ ਸਾਫ਼ ਅਤੇ ਤਾਜ਼ਾ ਪਾਣੀ ਪੀਣ ਤਾਂ ਉਹਨਾਂ ਨੂੰ ਬਿਮਾਰੀਆਂ ਤੋਂ ਬਚਾ ਹੋ ਸਕਦਾ ਹੈ ਪਾਣੀ ਦੇ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਡਾਇਰੀਆ ਅਤੇ ਹੋਰ ਇਨਫੈਕਸ਼ਨਾਂ ਤੋਂ ਬਚਿਆ ਜਾ ਸਕਦਾ ਹੈ ਪਾਣੀ ਦੇ ਨਾਲ ਨਾਲ ਪਾਣੀ ਦੀ ਸਾਫ਼ ਸਪਲਾਈ ਨਾ ਸਮੁੱਚੇ ਇਲਾਕੇ ਵਿੱਚ ਸਿਹਤ ਦੀ ਸੰਭਾਲ ਸੁਧਾਰ ਹੋ ਸਕਦੀ ਹੈ ਅਤੇ ਲੋਕਾਂ ਦੀ ਮੌਤ ਦੇ ਦਰ ਨੂੰ ਘਟਾਇਆ ਜਾ ਸਕਦਾ ਹੈ ਪਾਣੀ ਦੀ ਉਪਲੱਬਧਤਾ ਅਤੇ ਜੀਵਨ ਦੀ ਗੁਣਵੱਤਾ ਜੇ ਤੁਹਾਨੂੰ ਟੂਟੀ ਤੋਂ ਸਾਫ਼ ਪਾਣੀ ਮਿਲਦਾ ਹੈ ਤਾਂ ਤੁਸੀਂ ਆਪਣੇ ਦਿਨ ਚਰਿਆ ਅਤੇ ਜੀਵਨ ਦੀ ਗੁਣਵੱਤਾ ਬਿਹਤਰ ਤਰੀਕੇ ਨਾਲ ਜੀ ਸਕਦੇ ਹੋ ਸਾਫ਼ ਪਾਣੀ ਦਾ ਉਪਭੋਗ ਕਰਨਾ ਜਿਵੇਂ ਕਿ ਮਾਂਜਣਾ ਪਿਆਉਣਾ ਪਾਣੀ ਪੀਣਾ ਖਾਣਾ ਬਣਾਉਣਾ ਦੇ ਨਾਲ ਨਾਲ ਹੋਰ ਸਾਰੇ ਜੀਵਨ ਵਿੱਚ ਅੰਗ ਸੁਚੱਜੇ ਰਹਿੰਦੇ ਹਨ ਪਰਿਆਵਰਨ 'ਤੇ ਅਸਰ ਸਾਫ਼ ਪਾਣੀ ਨਾ ਸਿਰਫ਼ ਸਿਹਤ ਲਈ ਜ਼ਰੂਰੀ ਹੈ ਬਲਕਿ ਇਸ ਦੇ ਨਾਲ ਸਾਡਾ ਆਸਾ ਪਾਸਾ ਵੀ ਸੰਭਾਲਿਆ ਜਾ ਸਕਦਾ ਹੈ ਜੇ ਪਾਣੀ ਦੀ ਸਾਫ਼ ਸਪਲਾਈ ਹੋਵੇਗੀ ਤਾਂ ਇਹ ਸੰਗਰਹਿਤ ਕਰਕੇ ਵਿਵਹਾਰ ਕਰਨ ਵਿੱਚ ਮਦਦ ਕਰੇਗਾ ਅਤੇ ਪਾਣੀ ਦੀ ਵਰਤੋਂ ਦੂਜਿਆਂ ਬਿਨਾਂ ਬੇਅਰਥ ਜਗ੍ਹਾ 'ਤੇ ਨਹੀਂ ਹੁੰਦੀ ਇਸ ਨਾਲ ਸਾਡੇ ਘਰਾਂ ਖੇਤੀਬਾੜੀ ਖੇਤਰਾਂ ਅਤੇ ਹੋਰ ਖੇਤਰਾਂ ਵਿੱਚ ਬਰਾਬਰੀ ਨਾਲ ਵੰਡ ਹੋ ਸਕਦੀ ਹੈ ਪਾਣੀ ਦੀ ਗੰਦੀ ਸਪਲਾਈ ਅਤੇ ਨੁਕਸਾਨ ਸਿਹਤ ਦੇ ਮੁੱਦੇ ਜੇ ਪਾਣੀ ਸਾਫ਼ ਨਾ ਹੋਵੇ ਜਾਂ ਗੰਦਗੀਆਂ ਨਾਲ ਭਰਿਆ ਹੋਵੇ ਤਾਂ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਹਨ ਪਾਣੀ ਵਿੱਚ ਬੈਕਟੀਰੀਆ ਅਤੇ ਵਾਇਰਸ ਹੋ ਸਕਦੇ ਹਨ ਜੋ ਡਾਇਰੀਆ ਟਾਈਫਾਇਡ ਅਤੇ ਹੋਰ ਗੰਦੇ ਇਨਫੈਕਸ਼ਨਾਂ ਦਾ ਕਾਰਣ ਬਣ ਸਕਦੇ ਹਨ ਬਹੁਤ ਵਾਰ ਇਹ ਬਿਮਾਰੀਆਂ ਮੌਤ ਦਾ ਕਾਰਣ ਵੀ ਬਣ ਜਾਂਦੀਆਂ ਹਨ ਲੰਬੇ ਸਮੇਂ ਤੋਂ ਨੁਕਸਾਨ ਗੰਦੇ ਪਾਣੀ ਦੀ ਵਰਤੋਂ ਕਈ ਵਾਰ ਜ਼ਹਿਰੀਲੀਆਂ ਬਿਮਾਰੀਆਂ ਜਾਂ ਖਤਰਨਾਕ ਰੋਗਾਂ ਦਾ ਕਾਰਨ ਬਣ ਜਾਂਦੀਆਂ ਹਨ ਇਹ ਲੰਬੇ ਸਮੇਂ ਵਿੱਚ ਲੋਕਾਂ ਦੀ ਸਿਹਤ 'ਤੇ ਬਹੁਤ ਬੁਰਾ ਅਸਰ ਪਾਉਂਦੇ ਹਨ ਇੱਥੇ ਕੁਝ ਮੁਲਕਾਂ ਅਤੇ ਇਲਾਕਿਆਂ ਵਿੱਚ ਇਸ ਨੂੰ ਲੰਬੇ ਸਮੇਂ ਤੱਕ ਠੀਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਨਤੀਜਾ ਸਾਫ਼ ਪਾਣੀ ਦੀ ਪ੍ਰਾਪਤੀ ਜਿਹੜਾ ਤੁਹਾਡੇ ਜੀਵਨ ਵਿੱਚ ਖੁਸ਼ਹਾਲ ਖੁਸ਼ਹਾਲੀ ਸਿਹਤਮੰਦ ਜੀਵਨ ਲੈ ਕੇ ਆ ਸਕਦੀ ਹੈ ਬਿਹਤਰ ਜੀਵਨ ਜੀਣ ਦੀ ਉਮੀਦ ਆਪਾਂ ਰੱਖ ਸਕਦੇ ਹਾਂ ਜੇ ਤੁਹਾਨੂੰ ਸਾਫ਼ ਪਾਣੀ ਮਿਲੇਗਾ ਤਾਂ ਅਸੀਂ ਬਿਹਤਰ ਜੀਵਨ ਜੀਵਾਂਗੇ ਇਹ ਤੁਹਾਡੇ ਸਿਹਤ ਅਤੇ ਆਮ ਜੀਵਨ ਦਾ ਮੂਲ ਆਧਾਰ ਹੈ